ਪਸ਼ੂ ਪਾਲਣ ਦੇ ਕਿਤੇ ਉੱਤੇ ਬਹੁਤ ਸਾਰੇ ਆਰਥਿਕ ਮਸਲਿਆਂ ਉੱਤੇ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਪਸ਼ੂ ਪਾਲਣ ਲਈ ਸਾਨੂੰ ਚਾਹੀਦਾ ਕਿ ਇਹ ਸਾਨੂੰ ਜਿਹੜੀ ਆ ਪਸ਼ੂਆਂ ਦੇ ਰਹਿਣ ਲਈ ਪ੍ਰੋਪਰ ਸ਼ੈੱਡ ਹੋਣੀ ਚਾਹੀਦੀ ਹੈ ਉਹਨਾਂ ਦੇ ਰਹਿਣ ਲਈ ਪ੍ਰੋਪਰ ਸ਼ੈੱਡ ਦੇ ਨਾਲ ਨਾਲ ਉਹਨਾਂ ਦੇ ਖਾਣ ਲਈ ਚਾਰਾ ਵਧੀਆ ਜਿਹੜਾ ਆ ਹੋਣਾ ਚਾਹੀਦਾ ਉਹਨਾਂ ਦੇ ਖਾਣ ਲਈ ਫੀਡ ਜਿਹੜੀ ਆ ਹੋਣੀ ਚਾਹੀਦੀ ਆ ਉਹਨਾਂ ਦਾ ਚੋਖਰ ਉਹਨਾਂ ਦਾ ਜਿਹੜਾ ਆ ਉਹਨਾਂ ਲਈ ਵਧੀਆ ਜਿਹੜਾ ਆ ਚਾਰਾ ਹੋਣਾ ਚਾਹੀਦਾ ਹੈ ਪਾਣੀ ਦਾ ਪ੍ਰਬੰਧ ਜਿਹੜਾ ਆ ਉਹ ਪੂਰਾ ਹੋਣਾ ਚਾਹੀਦਾ ਹੈ ਅਤੇ ਇਹ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਮੈਡੀਕਲ ਸਮੇਂ ਸਮੇਂ 'ਤੇ ਮੈਡੀਕਲ ਕਰਵਾਉਣ ਲਈ ਆਰਥਿਕ ਜਿਹੜੀ ਏ ਕਿਸੇ ਪ੍ਰਕਾਰ ਦੀ ਤੰਗੀ ਨਾ ਹੋਵੇ ਕਿਉਂਕਿ ਪਸ਼ੂਆਂ ਦਾ ਮੈਡੀਕਲ ਜਿਹੜਾ ਆ ਉਹ ਬਹੁਤ ਜ਼ਰੂਰੀ ਹੁੰਦਾ ਹੈ ਇਸ ਦੇ ਨਾਲ ਉਹ ਘਾਤਕ ਜਿਹੜੇ ਆ ਬਣ ਜਾਂਦੇ ਹਨ ਜਾਂ ਉਹਨਾਂ ਦੀ ਜਿਹੜੀ ਆ ਪਸ਼ੂ ਜਿਹੜੇ ਆ ਬਿਮਾਰ ਹੋ ਜਾਂਦੇ ਜਾਂ ਉਹਨਾਂ ਦੀ ਮੌਤ ਵੀ ਹੋ ਜਾਂਦੀ ਇਸ ਕਾਰਨ ਜਿਹੜੇ ਆ ਮੈਡੀਕਲ ਚੈਕ ਅਪ ਕਰਵਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਦੇ ਨਾਲ ਨਾਲ ਹੀ ਕਿ ਸਾਡੇ ਕਿ ਖੇਤਰ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਇੱਕ ਘਰ ਵਿੱਚ ਕੋਈ ਨਾ ਕੋਈ ਪਸ਼ੂ ਜਿਹੜਾ ਜ਼ਰੂਰ ਹੁੰਦਾ ਹੈ ਹਰ ਇੱਕ ਘਰ ਵਿੱਚ ਜਿਵੇਂ ਗਾਂ ਬੱਕਰੀ ਜਿਹੜੀ ਆ ਹਰ ਕੋਈ ਇਨਸਾਨ ਜਿਹੜਾ ਆ ਉਹ ਰੱਖਦਾ ਆ ਸਾਡੇ ਖੇਤਰ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਪਸ਼ੂ ਰੱਖੇਦੇ ਹਨ ਜਿਵੇਂ ਕਿ ਗਾਂ ਬੱਕਰੀ ਆਦਿ ਜਿਹੜੇ ਆ ਮੱਝਾਂ ਰੱਖੀ ਦੀਆਂ ਹਨ ਕਿਉਂਕਿ ਇਹਨਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਕਿਉਂਕਿ ਪਸ਼ੂਆਂ ਨੂੰ ਜਿਹੜੇ ਆ ਪਸ਼ੂਆਂ ਦੇ ਦੁਆਰਾ ਦੁੱਧ ਘਿਓ ਮੱਖਣ ਆਦਿ ਜਿਹੜਾ ਆ ਉਹ ਘਰ ਵਿੱਚ ਹੀ ਸਾਰਾ ਕੁਛ ਜਿਹੜਾ ਆ ਮਿਲ ਜਾਂਦਾ ਹੈ ਇਸ ਕਾਰਨ ਜਿਹੜੇ ਆ ਇਹ ਸਬ ਦਿਆਂ ਫਾਇਦੇਮੰਦ ਹੋਣ ਦੇ ਨਾਲ ਉਹਨਾਂ ਨੂੰ ਬਾਹਰ ਜਾਣ ਦੀ ਜਿਹੜੀ ਆ ਦੁਕਾਨ ਨੂੰ ਇਹ ਸਭ ਲੈਣ ਦੀ ਜ਼ਰੂਰਤ ਜਿਹੜੀ ਨਹੀਂ ਪੈਂਦੀ ਕਿਉਂਕਿ ਸਾਰਾ ਕੁਛ ਅੱਜ ਕੱਲ੍ਹ ਮਿਲਾਵਟ ਦੇ ਵਿੱਚ ਹੁੰਦਾ ਅਤੇ ਇਸ ਕਾਰਨ ਇਹ ਜਿਹੜਾ ਬਹੁਤ ਹੀ ਫਾਇਦੇਮੰਦ ਹੈ